ਸਤਿ ਸ਼੍ਰੀ ਅਕਾਲ ਮੈਂ ਤੁਹਾਨੂੰ ਕੁਝ ਦੁਰਲੱਭ ਅਸਾਧਾਰਣ ਸਮੱਗਰੀਆਂ ਦੱਸਦੀ ਹਾਂ ਜਿੱਦਾਂ ਕਿ ਪਹਿਲਾਂ ਕਮਲ ਕਕੜੀ ਲੋਟਸਟੈਮ ਜੋ ਕਿ ਖ਼ਾਸ ਤੌਰ 'ਤੇ ਕੁਝ ਪੰਜਾਬੀ ਸਬਜ਼ੀਆਂ ਅਤੇ ਸਨੈਕਸ ਵਿੱਚ ਵਰਤੀਆਂ ਜਾਂਦੀਆਂ ਹਨ ਦੂਸਰੀ ਸਾਂਗਰੀ ਰਾਜਸਥਾਨ ਦਾ ਇੱਕ ਲੋਕਪ੍ਰਿਯ ਸੂਸਕ ਪਹਿਲ ਪਹਿਲੀ ਪਰ ਕੁਝ ਪੰਜਾਬੀ ਡਿਸਿਸ ਵਿੱਚ ਵੀ ਇਸਦਾ ਵਰਤਣ ਹੁੰਦਾ ਹੈ ਅੱਗੇ ਗੁਰਸ਼ੀ ਇੱਕ ਪ੍ਰਕਾਰ ਦਾ ਕਵਕ ਜਿਸ ਨੂੰ ਮਸਰੂਮ ਵੀ ਕਿਹਾ ਜਾਂਦਾ ਹੈ ਜੋ ਕਿ ਬਹੁਤ ਹੀ ਦੁਰਲੱਭ ਅਤੇ ਮਹਿੰਗਾ ਹੋ ਹੁੰਦਾ ਹੈ ਗੁੱਚੀ ਪਲਾਓ ਇੱਕ ਇੱਕ ਵਿਸ਼ੇਸ਼ ਪੰਜਾਬੀ ਡਿਸ ਹੈ ਅੱਗੇ ਕਾਲੀ ਗਾਜਰ ਕੁਝ ਟ੍ਰੈਡਿਸ਼ਨਲ ਪੰਜਾਬੀ ਡਰਿੰਕਸ ਜਿਵੇਂ ਕਿ ਕਾਂਚੀ ਵਿੱਚ ਵਰਤੀ ਜਾਂਦੀ ਹੈ ਭਟ ਦੀ ਦਾਲ ਇੱਕ ਪ੍ਰਕਾਰ ਦੀ ਦੁਰਲੱਭ ਕਾਲੀ ਦਾਲ ਹੈ ਜੋ ਕਿ ਖ਼ਾਸ ਤੌਰ 'ਤੇ ਕੁਝ ਰੀਜਨਸ ਵਿੱਚ ਹੀ ਮਿਲਦੀ ਹੈ ਜੰਗਲੀ ਲਸੁਨ ਜੋ ਕਿ ਕੁਝ ਟ੍ਰੈਡਿਸਨਲ ਪੰਜਾਬੀ ਡਿਸਿਸ ਵਿੱਚ ਉਪਯੋਗ ਕੀਤਾ ਜਾਂਦਾ ਹੈ ਪਰ ਇਹ ਮਿਲਣਾ ਬਹੁਤ ਹੀ ਮੁਸਕਿਲ ਹੁੰਦਾ ਹੈ ਇਹ ਸਮੱਗਰੀਆਂ ਦੁਰਲੱਭ ਹੋਣ ਦੀ ਵਜਹਾ ਤੋਂ ਇਹਨਾਂ ਨੂੰ ਆਪਣੀ ਰੈਸਪੀ ਵਿੱਚ ਸ਼ਾਮਿਲ ਕਰਨਾ ਇੱਕ ਖ਼ਾਸ ਪਹਿਚਾਣ ਬਣ ਜਾਂਦੀ ਹੈ ਥੈਂਕ ਧੰਨਵਾਦ ਜੀ